ਹੈਲੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਹਾਂਜੀ ਹਾਂਜੀ ਮੈਂ ਵੀ ਵਧੀਆ ਹੋਰ ਕਿੱਥੇ ਅੱਜ ਕੱਲ੍ਹ ਕੀ ਕਰਦੇ ਹੋ ਅੱਛਾ ਹੋਰ ਖੇਤੀਬਾੜੀ ਦਾ ਨਿੱਬੜ ਗਿਆ ਅੱਛਾ ਵਾਡੀ ਚੱਲਦੀ ਪਈ ਹੈ ਚੱਲੋ ਉੱਥੇ ਬਿਜੀ ਹੋਣੇ ਫਿਰ ਤਾਂ ਹੋਰ ਫਿਰ ਹੱਥਾਂ ਹੁੱਥਾਂ ਨਾਲ ਹੀ ਵੱਢਦੇ ਜਾ ਕੰਬੈਨ ਅੱਛਾ ਅੱਛਾ ਅੱਛਾ ਅੱਛਾ ਫਿਰ ਤੂੜੀ ਤਾੜੀ ਵੀ ਬਣ ਜਾਂਦੀ ਹੋਣੀ ਫਿਰ ਤਾਂ ਹੱਥ ਨਾਲ ਤਾਂ ਚੱਲੋ ਵਧੀਆ ਵਧੀਆ ਅੱਛਾ ਅੱਛਾ ਝਾੜ ਵੀ ਵਧੀਆ ਮੇਰੇ ਹਿਸਾਬ ਨਾਲ ਨਾ ਪਰ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਜੋ ਪਹਿਲਾਂ ਸੀ ਪਹਿਲਾਂ ਕਾਫ਼ੀ ਵਧੀਆ ਸੀ ਹਾਂ ਰੇਹਾਂ ਸਪ੍ਰੇਹਾਂ ਘੱਟ ਹੋ ਗਿਆ ਹੈ ਨਾ ਵਧੀਆ ਸੀ ਪਹਿਲਾਂ ਜਦੋਂ ਇਹ ਆਈ ਸੀ ਹਰੀ ਕ੍ਰਾਂਤੀ ਉਹਨੇ ਕਾਫ਼ੀ ਵਧੀਆ ਕਰਤਾ ਸਾਡੇ ਲਈ ਉਦੋਂ ਛਿਆਹਟ ਪੈਂਹਟ ਛਿਆਹਟ ਦੇ ਵਿੱਚ ਤਾਂ ਵਧੀਆ ਚੱਲਦੀ ਰਹੀ ਹੈ ਅਤੇ ਉਸ ਤੋਂ ਬਾਅਦ ਫਿਰ ਤਾਂ ਕੰਮ ਡਾਊਨ ਹੀ ਹੁੰਦਾ ਰਿਹਾ ਉਹ ਤਾਂ ਇੱਕ ਵਾਰ ਅਮਰੀਕਾ ਤੋਂ ਜਿਹੜਾ ਵੀ ਆਪਣੇ ਕੋਲੋਂ ਹੁੰਦਾ ਸੀ ਸਮਾਨ ਸਾਰਾ ਬੰਦ ਕਰਾ ਤਾ ਸੀ ਹੁਣ ਬਸ ਹੁਣ ਤਾਂ ਖਤਮ ਹੀ ਹੋ ਚੱਲਿਆ ਸਿਸਟਮ ਉਹਦੇ ਕਰਕੇ ਨਾ ਇਹ ਆਪਣੇ ਰੇਹਾਂ ਸਪ੍ਰੇਹਾਂ ਜਿਹੀਆਂ ਹੋਣ ਲੱਗ ਗਈਆਂ ਉਹਦੇ ਕਰਕੇ ਖਤਮ ਕਰੀ ਜਾਂਦੇ ਪਏ ਨੇ ਤੁਹਾਡੇ ਵਾਲੀ ਸਾਈਡ ਵੀ ਹੋਈ ਹੈ ਕੋਈ ਨੁਕਸਾਨ ਹੋ ਰਿਹਾ ਕਿ ਠੀਕ ਚੱਲੀ ਜਾਂਦਾ ਤੁਹਾਡੇ ਵਾਲੀ ਸਾਈਡ ਵੀ ਮੈਂ ਕਿਹਾ ਹੋਈ ਹੈ ਧਰਤੀ ਜਮੀਨ ਕੇ ਸਹੀ ਹੈ ਅੱਛਾ ਅੱਛਾ ਮਤਲਬ ਉਹ ਹੀ ਹੈ ਵੀ ਇਹਨਾਂ ਕਰਕੇ ਖਾਦਾਂ ਖੂਦਾਂ ਦਾ ਵੀ ਖਤਮ ਹੋ ਗਿਆ ਸਿਸਟਮ ਸਾਰਾ ਹੀ

ਤੁਸੀਂ ਕਿਵੇਂ ਫਿਰ ਆਰਗੈਨਿਕ ਹੀ ਕਰਦੇ ਹੋ ਸਪਰੇ ਵਗੈਰਾ ਜਾਂ ਦੂਜੀ ਰਸਾਇਣਿਕ ਚੱਲਦੀ ਹੈ ਅੱਛਾ ਅੱਛਾ ਫਿਰ ਤਾਂ ਵਧੀਆ ਚੱਲੋ ਕੁਛ ਨਾ ਕੁਛ ਤਾਂ ਆਰਗੈਨਿਕ ਚੱਲਦਾ ਹੈ ਨਾ ਪਰ ਅੱਜ ਕੱਲ੍ਹ ਮੈਨੂੰ ਲੱਗਦਾ ਨਹੀਂ ਵੀ ਹਾਂ ਹੁੰਦੇ ਹੀ ਸੀ ਜਿਵੇਂ ਫਸਲਾਂ ਨੂੰ ਬਚਾਉਣ ਲਈ ਕੀੜਿਆ ਮਕੌੜਿਆਂ ਦਾ ਹੈ ਨਾ ਫਿਰ ਵੀ ਰਸਾਇਣਿਕ ਚੀਜ਼ਾਂ ਹੀ ਵਰਤੀਆਂ ਜਾਂਦੀਆਂ ਨੇ ਚੱਲੋ ਚੱਲੋ ਹੋਰ ਵੀ ਕੋਈ ਫਸਲਾਂ ਫੁਸਲਾਂ ਉਗਾਉਂਦੇ ਹੋ ਇੱਧਰ ਤੁਸੀਂ ਅੱਛਾ ਅੱਛਾ ਚੱਲੋ ਚੱਲੋ ਇਸ ਤੋਂ ਬਾਅਦ ਫਿਰ ਹੁਣ ਠੀਕ ਹੈ ਠੀਕ ਹੈ ਅਤੇ ਹੁਣ ਕਣਕ ਦੀ ਵਾਢੀ ਤੋਂ ਬਾਅਦ ਕਾਹਦੀ ਤਿਆਰੀ ਅੱਛਾ ਅੱਛਾ ਉਹਦੇ ਲਈ ਵੀ ਪਾਣੀ ਕਾਫ਼ੀ ਵੇਸਟ ਹੀ ਹੋ ਜਾਂਦਾ ਚੱਲੋ ਹੋਰ ਘਰ ਪਰਿਵਾਰ ਸਭ ਠੀਕ ਹੋ ਹਾਂ ਹਾਂ ਵਧੀਆ ਚੱਲੋ ਠੀਕ ਹੈ ਫਿਰ ਮਿਲਦੇ ਹਾਂ ਕਿਸੇ ਦਿਨ ਠੀਕ ਹੈ ਜੀ